ਸਤਿ ਸ਼੍ਰੀ ਅਕਾਲ ਮੈਂ ਸਵੀਗੀ ਤੋਂ ਕਾਫ਼ੀ ਟਾਇਮ ਤੋਂ ਖਾਣਾ ਔਡਰ ਕਰਦੀ ਰਹੀ ਹਾਂ ਪਰ ਹੁਣ ਮੁਸੀਬਤ ਇਹ ਆ ਗਈ ਏ ਕਿ ਮੈਂ ਆਪਣਾ ਘਰ ਚੇਂਜ ਕਰ ਲਿਆ ਏ ਜਿਸ ਕਰਕੇ ਮੈਨੂੰ ਮੇਰਾ ਪਤਾ ਵੀ ਬਦਲਣਾ ਪਿਆ ਏ ਪਰ ਜਿਹੜਾ ਤੁਹਾਡੇ ਕੋਲ ਮੇਰਾ ਪਤਾ ਹੈ ਉਹ ਮੇਰੇ ਪਹਿਲੇ ਘਰ ਦਾ ਹੈ ਤਾਂ ਮੈਂ ਤੁਹਾਨੂੰ ਬੇਨਤੀ ਕਰਨਾ ਚਾਹੁੰਦੀ ਹਾਂ ਕਿ ਕਿਰਪਾ ਕਰਕੇ ਮੇਰਾ ਉਹ ਪਤਾ ਬਦਲ ਦਿੱਤਾ ਜਾਵੇ ਅਤੇ ਜਿਹੜਾ ਤੁਹਾਡਾ ਖਾਣਾ ਹੈ ਉਹ ਬਹੁਤ ਹੀ ਵਧੀਆ ਹੁੰਦਾ ਹੈ ਅਤੇ ਮੈਂ ਤੁਹਾਡੇ ਤੋਂ ਹੀ ਖਾਣਾ ਲੈਣਾ ਚਾਹੁੰਦੀ ਹਾਂ ਤਾਂ ਮੇਰਾ ਪਤਾ ਬਦਲ ਪੁਰਾਣੇ ਘਰ ਦਾ ਬਦਲ ਕੇ ਹੁਣ ਨਵੇਂ ਘਰ ਦਾ ਕੀਤਾ ਜਾਵੇ ਕਿਉਂਕਿ ਮੈਂ ਪਹਿਲੇ ਪਟਿਆਲੇ ਰਹਿੰਦੀ ਸੀ ਤਾਂ ਹੁਣ ਮੈਂ ਪਟਿਆਲੇ ਤੋਂ ਸ਼ਿਫਟ ਕਰਕੇ ਘਨੌਰ ਪਿੰਡ ਵਿੱਚ ਆ ਗਈ ਹਾਂ ਧੰਨਵਾਦ